ਮੈਂ ਇੱਕ ਪਿੰਡ ਦੀ ਨਿਵਾਸੀ ਹਾਂ ਅਤੇ ਇੱਥੇ ਬਾਹਰ ਤੋਂ ਆਉਣ ਵਾਲ਼ੇ ਲੋਕਾਂ ਲਈ ਕੋਈ ਵੀ ਹੋਮ ਸਟੇਅ ਨਹੀਂ ਹੈ